ਥੋੜ੍ਹੇ ਦਿਨ ਪਹਿਲਾਂ ਮੈਂ ਸਕਿੰਨ ਕੇਅਰ ਪ੍ਰੋਡਕਟ ਲਿਤਾ ਜਿਸ ਬਾਰੇ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਕਿਉਂਕਿ ਮੇਰੀ ਸਕਿੰਨ ਬਹੁਤ ਓਈਲੀ ਹੈ ਅਤੇ ਕੋਈ ਵੀ ਮੈਨੂੰ ਪ੍ਰੋਡਕਟ ਸਹੀ ਤਰ੍ਹਾਂ ਸੂ ਸਹੀ ਤਰ੍ਹਾਂ ਮੈਨੂੰ ਸੂਟ ਨਹੀਂ ਕਰਦਾ ਕਈ ਵਾਰ ਮੈਨੂੰ ਕੁਝ ਸਕਿੰਨ ਰੈਸਿਜ਼ ਹੋ ਜਾਂਦੇ ਪਰ ਤੁਹਾਡਾ ਪ੍ਰੋਡਕਟ ਯੂਜ ਕਰਕੇ ਮੇਰੀ ਸਕਿੰਨ ਬਹੁਤ ਜ਼ਿਆਦਾ ਸ਼ਾਈਨੀ ਹੋ ਗਈ ਹੈ ਓਈਲੀ ਸਕਿੰਨ ਸੀ ਥੋੜ੍ਹਾ ਜਿਹਾ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਰਲੀਫ ਮਿਲਿਆ ਬਹੁਤ ਹੀ ਵਧੀਆ ਤੁਹਾਡਾ ਪ੍ਰੋਡਕਟ ਮੈਨੂੰ ਲੱਗਿਆ ਮੇਰਾ ਐਕਸਪੀਰੀਅੰਸ ਵੀ ਬਹੁਤ ਵਧੀਆ ਸੀ ਤੁਹਾਡੇ ਪ੍ਰੋਡਕਟ ਦਾ ਪ੍ਰਾਈਜ਼ ਵੀ ਰੀਜ਼ਨੇਬਲ ਸੀ ਅਤੇ ਇਜੀਲੀ ਅਵੇਲੇਬਲ ਹੈ ਨੀਅਰ ਸਟੋਰ ਤੋਂ ਜਿਸ ਕਰਕੇ ਕੋਈ ਮੈਨੂੰ ਜ਼ਿਆਦਾ ਕਿਤੇ ਕਿਸੇ ਹੋਰ ਐਪ ਤੋਂ ਜਾਂ ਕਿਸੇ ਹੋਰ ਸਟੋਰ ਤੋਂ ਮੈਨੂੰ ਲੱਭਣ ਦੀ ਲੋੜ ਨਹੀਂ ਪਈ ਤੁਹਾਡੇ ਪ੍ਰੋਡਕਟ ਰੀਜੀਨੇਬਲ ਹੈ ਕੁਆਲਿਟੀ ਵਧੀਆ ਕੁਆਂਟਿਟੀ ਵਧੀਆ ਤੁਹਾਡਾ ਹਰੇਕ ਪ੍ਰੋਡਕਟ ਅਲੱਗ ਅਲੱਗ ਕੁਆਂਟਿਟੀ ਕੁਆਲਿਟੀ 'ਚ ਮਿਲ ਜਾਂਦਾ ਜਿਸ ਕਰਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਮੇਰੀ ਸਕਿੰਨ ਬਹੁਤ ਜ਼ਿਆਦਾ ਸ਼ਾਈਨਿੰਗ ਹੋ ਗਈ ਹੈ ਅਤੇ ਮੇਰੀ ਸਕਿੰਨ ਸਕਿੰਨ ਟੈਨ ਵੀ ਹਟ ਗਏ ਹੈ ਅਤੇ ਜੋ ਪਿੰਪਲ ਵਗੈਰਾ ਸੀ ਉਹ ਵੀ ਬਹੁਤ ਮੇਰੇ ਜ਼ਿਆਦਾਤਰ ਸਹੀ ਹੋ ਗਏ ਹੈ